ਮੈਨੂੰ ਮੇਰੀ ਫਰੈਂਡ ਤੋਂ ਜਾਣਕਾਰੀ ਮਿਲੀ ਕਿ ਸਾਡੇ ਏਰੀਏ ਦੇ ਵਿੱਚ ਚਿੱਤਰਕਾਰੀ ਦੀ ਹੀ ਵਰਕਸ਼ਾਪ ਲੱਗ ਰਹੀ ਹੈ ਅਤੇ ਮੈਨੂੰ ਬਚਪਨ ਤੋਂ ਹੀ ਚਿੱਤਰਕਾਰੀ ਦਾ ਬੁਹਤ ਸ਼ੌਂਕ ਸੀ ਪਰ ਘਰ ਦੇ ਕੰਮਾਂ ਦੇ ਵਿੱਚ ਕਦੇ ਵਰਕਸ਼ਾਪ ਜਾਂ ਚਿੱਤਰਕਾਰੀ ਕਰਨ ਦਾ ਮੌਕਾ ਨਹੀਂ ਮਿਲਿਆ ਸੋ ਮੈਂ ਉੱਥੇ ਗਈ ਅਤੇ ਮੈਂ ਆਪਣੀ ਐਡਮਿਸ਼ਨ ਲਈ ਉਹਦੇ ਵਿੱਚ ਅਤੇ ਮੈਨੂੰ ਵੈਸੇ ਵੀ ਇੱਦਾਂ ਹੀ ਲੱਗਦਾ ਕਿ ਸਿੱਖਣ ਦਾ ਸ਼ੌਂਕ ਜਾਂ ਸਿੱਖਣਾ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਲਾਈਫ ਵਿੱਚ ਸਿੱਖਦੇ ਰਹਿਣਾ ਹੀ ਚਾਹੀਦਾ ਉੱਥੇ ਜਾ ਕੇ ਮੈਨੂੰ ਰੰਗਾਂ ਦੀ ਜਾਣਕਾਰੀ ਰੰਗਾਂ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਰੰਗਿਆ ਜਾ ਸਕਦਾ ਹੈ ਕਿਵੇਂ ਦਿਮਾਗ ਦੇ ਵਿੱਚ ਜੋ ਚਿੱਤਰ ਹਨ ਉਹ ਆਪਾਂ ਇੱਕ ਕਾਗਜ਼ 'ਤੇ ਰੰਗਾਂ ਦੇ ਜ਼ਰੀਏ ਬਣਾ ਸਕਦੇ ਹਾਂ ਚਿੱਤਰਕਾਰੀ ਇੱਕ ਇਹੋ ਜਿਹਾ ਗੁਣ ਹੈ ਜਿਸ ਦੇ ਵਿੱਚ ਅਸੀਂ ਆਪਣੇ ਮਨ ਦੇ ਭਾਵ ਦਰਸ਼ਾ ਸਕਦੇ ਹਾਂ ਜਾਂ ਇੰਝ ਕਹਿ ਲਓ ਕਿ ਆਪਣੇ ਦਿਮਾਗ ਵਿੱਚ ਚੱਲਦੀਆਂ ਗੱਲਾਂ ਨੂੰ ਆਪਾਂ ਰੰਗਾਂ ਰਾਹੀਂ ਇੱਕ ਕਾਗਜ਼ 'ਤੇ ਉਤਾਰ ਸਕਦੇ ਹਾਂ ਸੋ ਚਿੱਤਰਕਾਰੀ ਦੀ ਵਰਕਸ਼ਾਪ ਲਾ ਕੇ ਮੈਨੂੰ ਪੰਦਰਾਂ ਦਿਨਾਂ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਿਆ ਮੈਨੂੰ ਇੱਦਾਂ ਲੱਗਿਆ ਕਿ ਜਿਵੇਂ ਮੇਰੀ ਜ਼ਿੰਦਗੀ ਰੰਗਾਂ ਦੇ ਵਿੱਚ ਰੰਗੀ ਜਾ ਚੁੱਕੀ ਹੈ ਜਦੋਂ ਕਿ ਇਹ ਚਿੱਤਰਕਾਰੀ ਮੈਂ ਬਹੁਤ ਟਾਈਮ ਬਾਅਦ ਸ਼ੁਰੂ ਕੀਤੀ ਸੀ ਬਚਪਨ ਵਿੱਚ ਕਰਦੇ ਸੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਘਰ ਦੇ ਕੰਮਾਂ ਦੇ ਵਿੱਚ ਚਿੱਤਰਕਾਰੀ ਦੂਰ ਹੁੰਦੀ ਗਈ ਪਰ ਵਰਕਸ਼ਾਪ ਸੁਣਦੇ ਹੀ ਮੇਰੇ ਮਨ ਦੇ ਵਿੱਚ ਉਮੰਗਾਂ ਜਾਗੀਆਂ ਕਿ ਮੈਂ ਵੀ ਚਿੱਤਰਕਾਰੀ ਦੀ ਕੁਛ ਕੁ ਦਿਨ ਕਲਾਸਾਂ ਲਗਾਵਾਂ ਇਸ ਕਰਕੇ ਮੈਨੇ ਚਿੱਤਰਕਾਰੀ ਦੀ ਵਰਕਸ਼ਾਪ ਦੇ ਵਿੱਚ ਗਈ ਅਤੇ ਉੱਥੇ ਬਹੁਤ ਕੁਛ ਸਿੱਖਿਆ